ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਮੈਂ ਨਕਦ ਰਾਹੀਂ ਆਪਣਾ ਭੁਗਤਾਨ ਕਰ ਸਕਦਾ ਹਾਂ ਕਿਉਂਕਿ ਅੱਜ ਕੱਲ ਨਵੀਂ ਨਵੀਂ ਤਕਨੀਕਾਂ ਆ ਗਈਆਂ ਹਨ ਭੁਗਤਾਨ ਕਰਨ ਲਈ ਅਤੇ ਮੈਂ ਇਹ ਪੁੱਛਣਾ ਚਾਹ ਰਿਹਾ ਹਾਂ ਕਿ ਕੀ ਉਹ ਨਵੀਂ ਤਕਨੀਕ ਤੁਸੀਂ ਰੱਖਦੇ ਹੋ ਜਾਂ ਤੁਸੀਂ ਸਿਰਫ ਨਕਦ ਰਾਹੀਂ ਹੀ ਭੁਗਤਾਨ ਲੈਂਦੇ ਹੋ ਕਿਉਂਕਿ ਜੇ ਤੁਸੀਂ ਰੱਖਦੇ ਹੋ ਤਾਂ ਨਗਦ ਰੱਖਣ ਲਈ ਮੇਰੇ ਲਈ ਇਹ ਸਹੂਲੀਅਤ ਹੋ ਜਾਵੇਗੀ ਕਿ ਮੈਂ ਦੂਜੇ ਤਕਨੀਕ ਰਾਹੀਂ ਵੀ ਤੁਹਾਨੂੰ ਭੁਗਤਾਨ ਕਰ ਸਕਦਾ ਹਾਂ